ਅੰਮ੍ਰਿਤਸਰ ਜ਼ਿਲ੍ਹੇ ਵਿੱਚ ਮੁੱਖ ਮਨੋਰੰਜਨ ਗਤੀਵਿਧੀਆਂ ਮਨੋਰੰਜਨ ਅਤੇ ਵਿਕਲ ਉਹ ਸਾਰੇ ਵਿਕਲਪ ਹਨ ਇਹਦੇ ਪਾਰਕ ਪਾਰਕ ਸਹੂਲਤਾਂ ਖੇਡੇ ਹਨ ਅਤੇ ਥੀਏਟਰ ਹਨ ਥੀਏਟਰ ਹਨ ਅਤੇ ਪਾਰਕ 'ਚ ਜਾਣ ਲਈ ਕੋਈ ਵੀ ਪੈਸਾ ਨਹੀਂ ਲਿਆ ਜਾਂਦਾ ਕੋਈ ਅਮੀਰ ਹੋਵੇ ਗਰੀਬ ਹੋਵੇ ਇਸ ਲਈ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ ਮੇਰੇ ਘਰ ਲਾਗੇ ਬਹੁਤ ਸਾਰੇ ਖੇਡ ਦੇ ਮੈਦਾਨ ਹਨ ਪ ਅਤੇ ਇੱਥੇ ਬੱਚਿਆਂ ਲਈ ਪੰਗੂੜੇ ਝੂਟੇ ਲੱਗੇ ਹੋਏ ਹਨ ਅਤੇ ਵੱਡੇ ਵੀ ਜਾ ਕੇ ਇੱਥੇ ਐਕਸਰਸਾਈਜ਼ ਕਰ ਸਕਦੇ ਹਨ ਕਿਸੇ ਕੋਲੋਂ ਕੋਈ ਪੈਸਾ ਵੀ ਨਹੀਂ ਲਿਆ ਜਾਂਦਾ ਗੋਲਡਨ ਟੈਂਪਲ ਦੇ ਕੋਲ ਵੀ ਬਾਹਰ ਖੇਡਣ ਲਈ ਬਹੁਤ ਸਾਰੀ ਪਾਰਕ ਬਣਾਈ ਗਈ ਹੈ ਨਿਊਜਮ ਬਣਾਇਆ ਗਿਆ ਹੈ ਉਸ ਵਿੱਚ ਵੀ ਕੋਈ ਪੈਸਾ ਨਹੀਂ ਲਿਆ ਜਾਂਦਾ ਮੁਫਤ ਹਨ ਸਰਕਾਰ ਨੇ ਬਹੁਤ ਸਾਰੀਆਂ ਸਹੂਲਤਾਂ ਦਿੱਤੀਆਂ ਹਨ ਜਿਵੇਂ ਕਿ ਅਲਫਾਵਨ ਦੇ ਮੌਲ ਵਿੱਚ ਕਈ ਥੀਏਟਰ ਹਨ ਘਰ ਦੇ ਲਾਗੇ ਸਟਰੀਲੀਅਮ ਮੋਲ ਹੈ ਘੁੰਮਣ ਲਈ ਮੰਨੋਰੰਜਨ ਦੇ ਬਹੁਤ ਸਾਰੇ ਪ ਪਾਰਕ ਹਨ